ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਮੇਰੀ ਸ਼ੋਪ ਹੈ ਜੀ ਮੈਂ ਆਰਗੈਨਿਕ ਸਬਜ਼ੀਆਂ ਵੇਚਦੀ ਜਿਵੇਂ ਕੱਦੂ ਤੋਰੀਆਂ ਕਰੇਲੇ ਗੋਭੀ ਫਲੀਆਂ ਵਗੈਰਾ ਸਾਰਾ ਸਾਰੀਆਂ ਸਬਜ਼ੀਆਂ ਹੁੰਦੀਆਂ ਨੇ ਲਗਭਗ ਸਾਡੀ ਸ਼ੋਪ ਤੋਂ ਬਹੁਤ ਥਾਵਾਂ 'ਤੇ ਜਿਵੇਂ ਗੁਰਦੁਆਰਾ ਸਾਹਿਬ ਵਿਆਹਾਂ ਸ਼ਾਦੀਆਂ ਵੇਲੇ ਵੀ ਬਹੁਤ ਜ਼ਿਆਦਾ ਮਤਲਬ ਸਬਜ਼ੀਆਂ ਜਾਂਦੀਆਂ ਨੇ ਜਿਹੜੀ ਵੀ ਤੁਹਾਨੂੰ ਚਾਹੀਦੀ ਹੋਈ ਉਹ ਤੁਸੀਂ ਲੈ ਸਕਦੇ ਹੋ ਕਦੋਂ ਮਰਜ਼ੀ ਸੋਪ ਅੱਛਾ ਮੇਰੀ ਸ਼ੋਪ ਜੀ ਕਚਹਿਰੀ ਚੌਂਕ ਦੇ ਵਿੱਚ ਹੀ ਹੈ ਹਾਂਜੀ ਪੁੱਲ ਉੱਤਰਦੇ ਸਾਰ ਹਾਂਜੀ ਕਿਹੜੀਆਂ ਕਿਹੜੀਆਂ ਚਾਹੀਦੀਆਂ ਤੁਹਾਨੂੰ ਹਾਂਜੀ ਹਾਂਜੀ ਪਨੀਰ ਵਗੈਰਾ ਵੀ ਮਿਲ ਜਾਂਦਾ ਹਾ ਹਾਂਜੀ ਹਾਂਜੀ ਜ਼ਰੂਰ ਮਿਲ ਜੂ ਜੀ ਕਿੰਨੀ ਕਿੰਨੀ ਹਾਂਜੀ ਹਾਂਜੀ ਬਿਲਕੁਲ ਫਰੈਸ਼ ਸਬਜ਼ੀਆਂ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਅਸੀਂ ਖਾਦਾਂ ਵਗੈਰਾ ਪਾ ਕੇ ਦੇਸੀ ਖਾਦਾਂ ਵਗੈਰਾ ਪਾ ਕੇ ਜਿੱਦਾਂ ਗੋਹਾ ਵਗੈਰਾ ਪਾ ਕੇ ਤਿਆਰ ਕਰਦੇ ਹਾਂ ਨਹੀਂ ਨਹੀਂ ਨਹੀਂ ਨਹੀਂ ਜੀ ਨਹੀਂ ਬਿਲਕੁੱਲ ਫ਼੍ਰੈਸ਼ ਸਬਜ਼ੀਆਂ ਮਿਲਣਗੀਆਂ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਓਕੇ ਓਕੇ ਠੀਕ ਹੈ ਜੀ ਠੀਕ ਹੈ ਜੀ ਕੋਈ ਨਹੀਂ ਓਕੇ ਤੁਸੀਂ ਜਦੋਂ ਮਰਜ਼ੀ ਆ ਜਿਓ ਓਕੇ ਓਕੇ